ਯਾਰ ਮੈਂ ਨਾ ਐਮਾਜ਼ੋਨ 'ਤੇ ਇੱਕ ਕਰੋਕਰੀ ਦੇ ਸਮਾਨ ਦੀ ਐਡ ਦੇਖੀ ਅਤੇ ਵੈਸੇ ਮੈਨੂੰ ਵਧੀਆ ਲੱਗਿਆ ਸਮਾਨ ਉਹ ਐਡ ਦੇ ਹਿਸਾਬ ਨਾਲ ਜਿਵੇਂ ਉਹਦਾ ਰੇਟ ਸੀਗਾ ਬਾਜ਼ਾਰ ਨਾਲੋਂ ਘੱਟ ਸੀ ਅਤੇ ਰੇਟ ਵੀ ਮੈਨੂੰ ਬਹੁਤ ਵਧੀਆ ਲੱਗਿਆ ਹੈ ਨਾ ਸਾਰਾ ਕੁਝ ਦੇਖ ਕੇ ਮੈਂ ਆਰਡਰ ਪਾਇਆ ਆਰਡਰ ਪਾਉਣ ਤੋਂ ਬਾਅਦ ਕਾਫ਼ੀ ਟਾਈਮ ਬਾਅਦ ਵੀ ਮੈਂ ਉਸ ਸਾਮਾਨ ਦੀ ਉਡੀਕ ਕੀਤੀ ਅਤੇ ਸਾਮਾਨ ਨਹੀਂ ਪਹੁੰਚਿਆ ਪਹਿਲੀ ਗੱਲ ਤਾਂ ਯਾਰ ਉਹ ਸਾਮਾਨ ਹੀ ਲੇਟ ਪਹੁੰਚਿਆ ਇੱਕ ਹਫ਼ਤਾ ਹੈ ਨਾ ਜੇ ਉਹ ਲੇਟ ਪਹੁੰਚਿਆ ਤਾਂ ਉਹ ਵੀ ਮੇਲ ਪਾਉਣ 'ਤੇ ਘਰ ਪਹੁੰਚਿਆ ਗਾ ਅਤੇ ਮੈਂ ਕਿਸੇ ਨੂੰ ਦੇਣਾ ਸੀ ਗਿਫਟ ਅਤੇ ਗਿਫਟ ਦਾ ਟਾਈਮ ਜਾਣੀ ਕਿ ਲੰਘ ਚੁੱਕਿਆ ਸੀਗਾ ਜਦੋਂ ਉਹ ਘਰ ਪਹੁੰਚਿਆ ਮੈਂ ਉਹਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਪ੍ਰੋਪਰ ਸਹੀ ਨਹੀਂ ਸੀਗਾ ਸਾਮਾਨ ਕਿਉਂਕਿ ਇੱਕ ਦੋ ਪਲੇਟਾਂ ਦੇ ਵਿੱਚ ਤਿੜਕੀਆਂ ਹੋਈਆਂ ਸੀ ਅਤੇ ਕੁਛ ਪਲੇਟਾਂ ਦੀਆਂ ਕੰਨੀਆਂ ਭੁਰੀਆਂ ਹੋਈਆਂ ਸੀਗੀਆਂ ਵੀ ਜਿਵੇਂ ਕਿ ਉਹ ਜ਼ਿੰਮੇਵਾਰੀ ਨਾ ਕਿਤੋਂ ਲੈ ਕੇ ਨਾ ਆਉਂਦਾ ਹੋਵੇ ਕਿਸੇ ਨੇ ਵੀ ਉਵੇਂ ਸਿੱਟ ਸੁੱਟ ਕੇ ਲਿਆਉਂਦਾ ਹੋਵੇ ਨਾ ਅਤੇ ਮੈਂ ਸਾਰਾ ਕੁਛ ਐਡ ਦੇਖ ਕੇ ਮੈਨੂੰ ਸੋਹਣਾ ਲੱਗਿਆ ਰੇਟ ਦੇਖ ਕੇ ਮੈਂ ਆਰਡਰ ਪਾਈ ਮੈਂ ਕਿਹਾ ਚੱਲੋ ਯਾਰ ਵਧੀਆ ਹੈ ਨਾ ਐਮਾਜ਼ੋਨ ਦਾ ਨਾਮ ਵੀ ਕਾਫ਼ੀ ਆ ਅਤੇ ਪਰ ਵੀ ਉਹ ਲੇਟ ਵੀ ਪਹੁੰਚਿਆ ਅਤੇ ਲੇਟ ਪਹੁੰਚਣ ਦੇ ਨਾਲ ਨਾਲ ਖ਼ਰਾਬ ਵੀ ਪਹੁੰਚਿਆ ਹੁਣ ਉਹਦਾ ਹੱਲ ਕੀ ਕੀਤਾ ਜਾਵੇ ਅਤੇ ਜਾਂ ਤਾਂ ਮੈਨੂੰ ਉਸਦੇ ਪੇਮੈਂਟ ਮਿਲ ਜਾਵੇ ਵਾਪਿਸ ਜਾਂ ਮੈਂ ਸਾਮਾਨ ਵਾਪਿਸ ਕਰਦਾ ਕੋਈ ਸਮਾਨ ਮੈਨੂੰ ਬਦਲ ਕੇ ਦੇ ਦੇਣ ਹੈ ਨਾ ਉਹ ਅਤੇ ਇਸ ਤਰ੍ਹਾਂ ਦਾ ਉਹਨਾਂ ਦੀ ਵੀ ਗਾਹਕ ਖ਼ਰਾਬ ਹੋਣਗੇ ਜੇ ਐਵੇਂ ਕੋਈ ਆਪਣੇ ਪੇਜ 'ਤੇ ਜਾਂ ਕਿਤੇ ਵੀ ਉਹਨਾਂ ਦੀ ਇਹ ਪਾਉਣਾ ਹੈਗਾ ਹੈ ਨਾ ਅਤੇ ਇਸ ਕਰਕੇ ਇਹਦਾ ਹੱਲ ਕਰਿਆ ਜਾਵੇ ਕੋਈ ਨਾ ਕੋਈ